ਹਾਂਜੀ ਮੈਂ ਮੈਨੂੰ ਪੇਂਟਿੰਗ ਪੇਂਟਿੰਗ ਬਣਾਉਣ ਦਾ ਬਹੁਤ ਸ਼ੌਕ ਹੈ ਮੇਰੇ ਮੇਰੇ ਕੋਲ ਇੱਕ ਤੋਤਿਆਂ ਦੀ ਪੁਰਾਣੀ ਪੇਂਟਿੰਗ ਹੈ ਜਿਹੜੀ ਅੱਜ ਤੋਂ ਮੈਂ ਪੱਚੀ ਸਾਲ ਚੌਵੀ ਸਾਲ ਪਹਿਲੇ ਬਣਾਈ ਸੀਗੀ ਅਤੇ ਉਸ 'ਤੇ ਮੇਰੇ ਮੁੰਡੇ ਦਾ ਨਾਂ ਲਿਖਿਆ ਹੋਇਆ ਅਤੇ ਮੁੰਡਾ ਮੇਰੇ ਤੋਂ ਦੂਰ ਰਹਿੰਦਾ ਅਤੇ ਜਦੋਂ ਵੀ ਮੈਂ ਉਹ ਪੇਂਟਿੰਗ ਆਪਣੇ ਪੇਕੇ ਘਰ ਜਾ ਕੇ ਦੇਖਦੀ ਹਾਂ ਤਾਂ ਮੈਨੂੰ ਪੇਂਟਿੰਗ 'ਤੇ ਆਪਣੇ ਮੁੰਡੇ ਦੀ ਅਤੇ ਜਦੋਂ ਮੈਂ ਉਹ ਪੇਂਟਿੰਗ ਸਿੱਖੀ ਸੀਗੀ ਉਹਦੀ ਮੈਨੂੰ ਬਹੁਤ ਯਾਦ ਆਉਂਦੀ ਹੈ ਬਹੁਤ ਪ੍ਰਭਾਵਿਤ ਕਰਦੀ ਆ